ਜਦੋਂ ਮੈਂ ਮੈਡੀਕਲ ਬੀ ਐੱਸਸੀ ਦੀ ਪੜ੍ਹਾਈ ਪੂਰੀ ਕੀਤੀ ਤਾਂ ਮੈਂ ਸੋਚਿਆ ਇਸ ਤੋਂ ਅੱਗੇ ਮੈਂ ਪੀ ਐਚ ਡੀ ਪਟਿਆਲਾ ਕੌਲ ਪਟਿਆਲਾ ਯੂਨੀਵਰਸਿਟੀ ਤੋਂ ਕਰਾਂ ਪਰ ਪਰ ਘਰ ਵਿੱਚ ਆਰਥਿਕ ਤੰਗੀ ਹੋਣ ਕਰਕੇ ਅਤੇ ਅਤੇ ਮੈਨੂੰ ਅਤੇ ਉੱਥੇ ਦੇ ਰਹਿਣ ਸਹਿਣ ਬਾਰੇ ਮਾਤਾ ਪਿਤ ਰਹਿਣ ਸਹਿਣ ਬਾਰੇ ਫੈਸਲਾ ਲੈਣ ਕਰਕੇ ਮੈਨੂੰ ਬਹੁਤ ਔਖੀ ਹੋਈ ਇਸ ਤੋਂ ਅਤੇ ਮਾਤਾ ਪਿਤਾ ਨੂੰ ਲੜਕੀ ਨੂੰ ਇੰਨੀ ਦੂਰ ਭੇਜਣਾ ਵੀ ਨਹੀਂ ਭੇਜਣਾ ਚਾਹੁੰਦੇ ਸਨ ਇਸ ਕਰਕੇ ਮਜ਼ਬੂਰਨ ਹੀ ਮੈਨੂੰ ਇਹ ਫੈਸਲਾ ਲੈਣਾ ਪਿਆ ਕਿ ਮੈਂ ਉੱਥੇ ਆਪਣੀ ਪੜ੍ਹਾਈ ਪੂਰ ਜਾਰੀ ਨਾ ਕਰਕੇ ਨੰਗਲ ਨੰਗਲ ਦੇ ਕੋਲ ਹੀ ਕਾਲਜ ਵਿੱਚ ਪੜ੍ਹਾਈ ਕਰਾਂ ਅਤੇ ਇਸ ਤੋਂ ਇਲਾਵਾ ਮੈਨੂੰ ਬਾਹਰ ਦਾ ਖਾਣਾ ਸੂਟ ਵੀ ਨਹੀਂ ਕਰਦਾ ਮੈਨੂੰ ਘਰ ਦਾ ਹੀ ਖਾਣਾ ਠੀਕ ਲੱਗਦਾ ਹੈ ਮੈਂ ਚਾਹੁੰਦੀ ਸੀ ਕਿ ਮੈਂ ਪੀ ਐਚ ਡੀ ਕਰਕੇ ਡਾਕਟਰ ਬਣਾ ਪ੍ਰੰਤੂ ਮੈਨੂੰ ਨੰਗਲ ਦੇ ਕਾਲਜ ਤੋਂ ਹੀ ਪੀ ਐਚ ਡੀ ਕਰਨੀ ਪਊਗੀ ਇਸ ਸਬੰਧੀ ਮੈਂ ਆਪਣੇ ਫੈਸਲੇ ਆਪਣੇ ਮਾਤਾ ਪਿਤਾ ਤੋਂ ਲੈਂਦੀ ਹਾਂ